ਅਸੀਂ ਆਪਣੇ ਖੇਤੀਬਾੜੀ ਤੋਂ ਇਲਾਵਾ ਬਾਗਬਾਨੀ ਵੀ ਕੀਤੀ ਹੋਈ ਹੈ ਬਾਗਬਾਨੀ ਵਿੱਚ ਅਸੀਂ ਕਈ ਤਰ੍ਹਾਂ ਦੀਆਂ ਸਬਜ਼ੀਆਂ ਜਿਵੇਂ ਭਿੰਡੀ ਤੋਰੀ ਬਤਾਉਂ ਵਗੈਰਾ ਲਗਾਏ ਹੋਏ ਹਨ ਉਹਨਾਂ ਵਿੱਚ ਸਮੇਂ ਸਮੇਂ ਸਿਰ ਖਾਦ ਵਗੈਰਾ ਪਾਉਣੀ ਪੈਂਦੀ ਹੈ ਦਵਾਈਆਂ ਦਾ ਛਿੜਕਾਅ ਘੱਟ ਤੋਂ ਘੱਟ ਕਰਦੇ ਹਾਂ ਅਤੇ ਉਹਨਾਂ ਨੂੰ ਟਾਈਮ 'ਤੇ ਪੱਕਣ ਤੋਂ ਪਹਿਲਾਂ ਤੋੜਿਆ ਜਾਂਦਾ ਹੈ ਘਰ ਦੀਆਂ ਸਬਜ਼ੀਆਂ ਵਧੀਆ ਹੁੰਦੀਆਂ ਹਨ ਉਹਨਾਂ ਵਿੱਚ ਪੌਸ਼ਟਿਕ ਅਹਾਰ ਸਭ ਤੋਂ ਵੱਧ ਹੁੰਦਾ ਹੈ